ਪਿਛਲੇ ਸਾਲਾਂ ਵਿੱਚ ਮੋਹਾਲੀ ਜ਼ਿਲ੍ਹੇ ਨੇ ਬਹੁਤ ਤਬਦੀਲੀ ਕਰੀ ਹੈ ਜਿਵੇਂ ਕਿ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਟਰਾਂਸਪੋਰਟ ਦੇ ਸਾਧਨ ਵਧੇ ਹਨ ਡੇ ਬਾਈ ਡੇ ਅਤੇ ਇਸਦੇ ਨਾਲ਼ ਹੀ ਹੋਰ ਬਹੁਤ ਲੋਕਾਂ ਨੂੰ ਫਸਿਲਟੀਆਂ ਪ੍ਰੋਵਾਈਡ ਹੋਈਆਂ ਹਨ ਜਿਵੇਂ ਕਿ ਬਹੁਤ ਇੱਥੇ ਘਰ ਬਣ ਗਏ ਹਨ ਜੋ ਕਿ ਬੜੀਆਂ ਬੜੀਆਂ ਬਿਲਡਿੰਗਾਂ ਵਿੱਚ ਤਬਦੀਲ ਹੋ ਗਏ ਹਨ ਅਤੇ ਇੱਥੇ ਬਹੁਤ ਸਭ ਤੋਂ ਬੜੀ ਗੱਲ ਹਵਾਈ ਅੱਡੇ ਦਾ ਵੀ ਸੁਵਿਧਾ ਹੈ ਜੋ ਕਿ ਹਰ ਇੱਕ ਜ਼ਿਲ੍ਹੇ ਵਿੱਚ ਉਪਲਬਧ ਨਹੀਂ ਹੈ ਅਤੇ ਸਭ ਤੋਂ ਬੜੀ ਗੱਲ ਇਹ ਹੈ ਕਿ ਇਹ ਚੰਡੀਗੜ੍ਹ ਦੇ ਨੇੜੇ ਲੱਗਦਾ ਹੈ ਚੰਡੀਗੜ੍ਹ ਦੇ ਨੇੜੇ ਲੱਗਣ ਕਾਰਨ ਇਹ ਸਭ ਤੋਂ ਟੋਪਐਸਟ 'ਤੇ ਚੱਲਦਾ ਹੈ ਅਤੇ